ਮੈਂ ਇਹ ਸਮਝਦਾ ਹਾਂ ਕਿ ਮੀਡੀਆ ਜਿਵੇਂ ਕਿ ਰੇਡੀਓ ਟੈਲੀਵਿਜ਼ਨ ਅਤੇ ਪ੍ਰਿੰਟ ਆਦਿ ਵਿੱਚ ਪੰਜਾਬੀ ਭਾਸ਼ਾ ਦੀ ਵਰਤੋਂ ਬਹੁਤ ਜ਼ਰੂਰੀ ਹੈ ਤਾਂ ਜੋ ਲੋਕ ਜਿਨ੍ਹਾਂ ਨੂੰ ਹੋਰ ਭਰਸ਼ਾ ਭਾਸ਼ਾਵਾਂ ਜਿਵੇਂ ਕਿ ਹਿੰਦੀ ਅੰਗਰੇਜ਼ੀ ਆਦਿ ਨਹੀਂ ਆਉਂਦੀਆਂ ਉਹ ਪੰਜਾਬੀ ਭਾਸ਼ਾ ਵਿੱਚ ਹੀ ਇਨ੍ਹਾਂ ਸੇਵਾਵਾਂ ਦਾ ਲਾਭ ਲੈ ਸਕਣ ਰੇਡੀਓ ਦੇ ਵਿੱਚ ਖਬਰਾਂ ਅਤੇ ਗੀਤ ਅਤੇ ਹੋਰ ਮਨੋਰੰਜਨ ਦੇ ਪ੍ਰੋਗਰਾਮ ਪੰਜਾਬੀ ਭਾਸ਼ਾ ਵਿੱਚ ਪ੍ਰਸਾਰਿਤ ਕੀਤੇ ਜਾ ਸਕਦੇ ਹਨ ਰੇਡੀਓ ਦੇ ਵਿੱਚ ਅਲੱਗ ਫਰੀਕੁਐਂਸੀ 'ਤੇ ਇੱਕ ਰੇਡੀਓ ਚੈਨਲ ਬਣਾਇਆ ਜਾ ਸਕਦਾ ਹੈ ਜੋ ਕਿ ਸਿਰਫ ਪੰਜਾਬੀ ਭਾਸ਼ਾ ਵਿੱਚ ਆਪਣੇ ਪ੍ਰੋਗਰਾਮ ਪ੍ਰਸਾਰਿਤ ਕਰੇ ਟੈਲੀਵਿਜ਼ਨ 'ਤੇ ਵੀ ਇਸੇ ਤਰ੍ਹਾਂ ਹੀ ਅਲੱਗ ਚੈਨਲ ਬਣਾਏ ਜਾ ਸਕਦੇ ਹਨ ਜਿਸਦੇ ਵਿੱਚ ਪੰਜਾਬੀ ਖਬਰਾਂ ਪੰਜਾਬੀ ਫਿਲਮਾਂ ਅਤੇ ਹੋਰ ਮਨੋਰੰਜਨ ਦੇ ਪ੍ਰੋਗਰਾਮ ਪੰਜਾਬੀ ਭਾਸ਼ਾ ਵਿੱਚ ਪ੍ਰਸਾਰਿਤ ਹੋਣ ਅਤੇ ਲੋਕ ਜਿਨ੍ਹਾਂ ਨੂੰ ਹੋਰ ਭਾਸ਼ਾਵਾਂ ਜਿਵੇਂ ਕਿ ਹਿੰਦੀ ਅੰਗਰੇਜ਼ੀ ਆਦਿ ਨਹੀਂ ਆਉਂਦੀਆਂ ਉਹ ਇਹਨਾਂ ਸ ਸੇਵਾਵਾਂ ਦਾ ਲਾਭ ਪੰਜਾਬੀ ਭਾਸ਼ਾ ਵਿੱਚ ਲੈ ਸਕਣ ਇਸੇ ਤਰ੍ਹਾਂ ਹੀ ਅਖਬਾਰ ਵੀ ਪੰਜਾਬੀ ਭਾਸ਼ਾਵਾਂ ਦੇ ਵਿੱਚ ਪ੍ਰਿੰਟ ਕੀਤੇ ਜਾ ਸਕਦੇ ਹਨ ਜਿਸ ਨਾਲ ਲੋਕ ਜਿਨ੍ਹਾਂ ਨੂੰ ਹਿੰਦੀ ਅਤੇ ਅੰਗਰੇਜ਼ੀ ਭਾਸ਼ਾ ਪੜ੍ਹਨੀ ਨਹੀਂ ਆਉਂਦੀ ਉਹ ਖਬਰਾਂ ਨੂੰ ਪੰਜਾਬੀ ਭਾਸ਼ਾ ਵਿੱਚ ਪੜ੍ਹ ਸਕਣ